ਕੱਲ੍ਹ ਮੈਂ ਆਪਣੇ ਬੱਚੇ ਦੇ ਸਕੂਲ ਗਿਆ ਪੀ ਟੀ ਐਮ ਸੀਗੀ ਅਤੇ ਉੱਥੇ ਨਾਲ ਉਹਨਾਂ ਨੇ ਨਾ ਇੱਕ ਬਣਾਇਆ ਹੋਇਆ ਸੀ ਛੋਟਾ ਜਿਹਾ ਐਕਟ ਜਿਹਾ ਸੀਗਾ ਬੱਚਿਆਂ ਨੇ ਕੀਤਾ ਬੜਾ ਪਿਆਰਾ ਐਕਟ ਸੀ ਬੜਾ ਮਨ ਨੂੰ ਜਚਿਆ ਕਿ ਮਤਲਬ ਰੀਸਾਈਕਲ ਬਾਰੇ ਦੱਸਿਆ ਉਹਨਾਂ ਨੇ ਬੜਾ ਜਚਿਆ ਮਨ ਨੂੰ ਕਿ ਆਪਾਂ ਰੀਸਾਈਕਲ ਕਰਕੇ ਬਹੁਤ ਅੱਛੀਆਂ ਅੱਛੀਆਂ ਚੀਜ਼ਾਂ ਬਣਾ ਸਕਦੇ ਕੁਛ ਚੀਜ਼ਾਂ ਜਿਹੜੀਆਂ ਉੱਥੇ ਮੈਂ ਉਹਨਾਂ ਨੂੰ ਜਿੱਦਾਂ ਦੇਖਿਆ ਮੈਂ ਕਿ ਆਪਣਾ ਪਲਾਸਟਿਕ ਨੂੰ ਰੀਸਾਈਕਲ ਕਿੱਦਾਂ ਕੀਤਾ ਜਾ ਸਕਦਾ ਨੁਕਸਾਨ ਕੀ ਨੇ ਜੇ ਆਪਾਂ ਰੀਸਾਈਕਲ ਨਹੀਂ ਕਰਦੇ ਬੜੀ ਜਚੀ ਯਾਰ ਛੋਟੇ ਬੱਚਿਆਂ ਦੇ ਮਨੋ ਸੁਣਕੇ ਕਿ ਮੈਨੂੰ ਵੀ ਲੱਗਿਆ ਕਿ ਜੇ ਛੋਟੇ ਬੱਚਿਆਂ ਨੂੰ ਅਸੀਂ ਇਹ ਚੀਜ਼ ਸਿਖਾ ਰਹੇ ਤਾਂ ਆਪਾਂ ਵੱਡੇ ਕਿਉਂ ਨਾ ਸਿੱਖਈਏ ਅਤੇ ਮੈਂ ਫਿਰ ਲੱਭਣਾ ਸ਼ੁਰੂ ਕੀਤਾ ਮੈਂ ਕਿਹਾ ਦੇਖੀਏ ਸ਼ਾਇਦ ਆਪਣੀ ਵੀ ਆਸ ਪਾਸ ਕੋਈ ਰੀਸਾਈਕਲ ਸੈਂਟਰ ਹੋਵੇ ਅਤੇ ਤੈਨੂੰ ਹੈ ਨਾਲੇਜ ਕਈ ਮਤਲਬ ਆਸ ਪਾਸ ਆਪਣੇ ਹੈਗਾ ਰੀਸਾਈਕਲ ਸੈਂਟਰ ਕੋਈ ਅੱਛਾ ਹੈਗਾ ਬਹੁਤ ਵਧੀਆ ਗੱਲ ਹੈ ਯਾਰ ਜੇ ਹੈਗਾ ਅਤੇ ਕਿੱਦਾਂ ਫਿਰ ਇਹ ਮਤਲਬ ਕੋ ਆਪਣਾ ਜੇ ਕੋਈ ਸਮਾਨ ਦੇਣਾ ਹੋਵੇ ਤਾਂ ਅਸੀਂ ਜਾ ਕੇ ਦੇਣਾ ਕਿ ਉਹ ਕਲੈਕਟ ਕਰ ਲੈਂਦੇ ਨੇ ਕਿੱਦਾਂ ਹੈ ਕੁਛ ਨੋਲੇਜ ਤੈਨੂੰ ਇਸ ਬਾਰੇ ਕਿ ਮੈਨੂੰ ਲੱਗਦਾ ਯਾਰ ਐਟਲੀਸਟ ਮੈਂ ਤਾਂ ਆਪਣੇ ਵੱਲੋਂ ਇਹ ਹਿੱਸਾ ਪਾਵਾਂ ਨਾ ਕਿਉਂਕਿ ਮੈਂ ਆਪਣੇ ਜਿਹੜਾ ਹੈਗਾ ਪਲਾਸਟਿਕ ਵਗੈਰਾ ਇਹਨੂੰ ਮੈਂ ਤਾਂ ਕਰਨਾ ਹੀ ਕਰਨਾ ਰੀਸਾਈਕਲ ਭੇਜਣਾ ਮੈਨੂੰ ਪਤਾ ਜੋ ਹਾਲ ਹੁਣ ਆਪਾਂ ਇਗਜਾਮਪਲ ਲੈ ਲਈਏ ਯਾਰ ਯਮੁਨਾ ਦਾ ਹੀ ਲੈ ਲਈਏ ਦਿੱਲੀ ਹਾਲ ਕਿੱਦਾਂ ਉਹ ਕੈਮੀਕਲ ਦੇ ਨਾਲ ਕੈਮੀਕਲ ਕਿੱਥੋਂ ਆ ਫੈਕਟਰੀਆਂ ਤੋਂ ਹੈ ਨਾ ਫੈਕਟਰੀਆਂ ਵੀ ਅਸੀਂ ਚੀਜ਼ਾਂ ਮੰਗਦੇ ਹਾਂ ਤਾਂ ਬਣਾਉਂਦੇ ਆ ਅਤੇ ਕਿਤੇ ਨਾ ਕਿਤੇ ਅਸੀਂ ਵੀ ਜਿੰਮੇਵਾਰ ਹਾਂ ਤਾਂ ਕਿਉਂ ਨਾ ਛੋਟਾ ਜਿਹਾ ਮੈਨੂੰ ਲੱਗਦਾ ਕਿ ਆਪਾਂ ਕਿ ਆਪਣੇ ਵੱਲ ਦਾ ਪਾਰਟ ਪਲੇ ਕਰ ਦੇਈਏ ਕਿ ਹਾਂ ਯਾਰ ਮੈਂ ਐਟਲੀਸਟ ਆਪਣੇ ਘਰ ਦਾ ਜਿਹੜਾ ਹੈਗਾ ਕੂੜਾ ਉਹਨੂੰ ਰੀਸਾਈਕਲਿੰਗ ਵਾਸਤੇ ਭੇਜਦਾਂ ਅੱਛਾ ਘਰੋਂ ਸ ਕਰ ਲੈਂਦੇ ਆ ਕਲੈਕਟ ਯਾਰ ਇਹ ਬਹੁਤ ਵਧੀਆ ਗੱਲ ਹੈ ਅਤੇ ਉਹਦੇ 'ਚ ਕੋਈ ਉਹ ਤਾਂ ਨਹੀਂ ਹੈਗੀ ਮਤਲਬ ਕਾਸੇ ਵਿੱਚ ਪਾ ਕੇ ਰੱਖਣਾ ਜਾਂ ਅਲੱਗ ਅਲੱਗ ਰੱਖਣਾ ਪਲਾਸਟਿਕ ਨੂੰ ਅਲੱਗ ਇੱਦਾਂ ਅਲੱਗ

ਠੀਕ ਹੈ ਅੱਛਾ ਮਤਲਬ ਦੱਸ ਦੂੰਗੇ ਉਹ ਜਾ ਕੇ ਕੱਢ ਯਾਰ ਟਾਈਮ ਫਿਰ ਆਪਾਂ ਕੱਲ੍ਹ ਜਾ ਕੇ ਆਈਏ ਮੈਂ ਬੜਾ ਮਨ ਕਰ ਰਿਹਾ ਕਿ ਆਪਾਂ ਕੁਛ ਇੱਦਾਂ ਦਾ ਕਰ ਲਈਏ ਇਹਦੇ ਬਾਰੇ